ਯੋਗਾ ਸ਼ੁਰੂ ਕਰਨ ਦੀ ਉਮਰ ਤਕਰੀਬਨ ਮੇਰੇ ਹਿਸਾਬ ਨਾਲ ਪੰਦਰ੍ਹਾਂ ਤੋਂ ਸੌਲ੍ਹਾਂ ਸਾਲ ਦੇ ਵਿੱਚ ਵਿੱਚ ਯੋਗਾ ਸ਼ੁਰੂ ਕਰਨ ਦੀ ਉਮਰ ਸਹੀ ਹੈ ਬਿਲਕੁਲ ਅਤੇ ਛੋਟੀ ਉਮਰ ਵਿੱਚ ਯੋਗਾ ਕਰਨ ਦੇ ਫਾਇਦੇ ਇਹ ਹਨ ਕਿ ਇੱਕ ਦਾ ਬੰਦਾ ਮੋਰਨਿੰਗ ਟਾਈਮ ਜਲਦੀ ਉੱਠ ਜਾਂਦਾ ਟਾਈਮ ਨਾਲ ਉੱਠ ਜਾਂਦਾ ਅਤੇ ਯੋਗਾ ਕਰਨ ਦਾ ਸਮਾਂ ਵੀ ਵੈਸੇ ਸਵੇਰ ਦਾ ਹੀ ਹੁੰਦਾ ਹੈ ਟਾਈਮ ਨਾਲ ਉੱਠਣਾ ਅਤੇ ਬੰਦਾ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਅਤੇ ਬੰਦੇ ਦਾ ਸਰੀਰ ਚੁਸਤ ਰਹਿੰਦਾ ਏ ਸਾਰਾ ਦਿਨ ਕੋਈ ਤੰਦਰੁਸਤ ਰਹਿੰਦਾ ਬੰਦੇ ਦਾ ਸਰੀਰ ਅਤੇ ਸਰੀਰ ਵਿੱਚ ਲਚਕੀਲਾਪਣ ਵੀ ਆ ਜਾਂਦਾ ਏ ਅਤੇ ਇਸ ਨਾਲ ਸਿਹਤ ਨੂੰ ਕੋਈ ਬਿਮਾਰੀ ਵਗੈਰਾ ਨਹੀਂ ਲੱਗਦੀ ਹੈਗੀ